ਜੀ ਮੈਨੂੰ ਸ਼ੇਅਰ ਮਾਰਕੀਟ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਮੇਰਾ ਇਹ ਵਿਸ਼ਾ ਨਹੀਂ ਹੈ ਮੈਂ ਇੱਕ ਟੀਚਰ ਦੀ ਇੱਕ ਜੋਬ ਕਰਦੀ ਹਾਂ ਅਤੇ ਕੋਈ ਵੀ ਉਤਰਾਅ ਚੜਾਅ ਜਾਂ ਮੌਜੂਦਾ ਬ ਵਿਚਾਰ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਡਿਜੀਟਲ ਐਪਸ ਨੇ ਭਾਰਤ ਦੇ ਵਪਾਰ ਨੂੰ ਇਸ ਹੱਦ ਤੱਕ ਬਦਲਿਆ ਹੈ ਕਿ ਜੋ ਛੋਟੇ ਵਪਾਰੀ ਹਨ ਉਹਨਾਂ ਦਾ ਇਸ ਜੱਗ 'ਤੇ ਜਿਉਣਾ ਔਖਾ ਹੋ ਗਿਆ ਹੈ ਛੋਟੇ ਵਪਾਰੀ ਇੰਨਾ ਪੈਸਾ ਨਹੀਂ ਲਾ ਸਕਦੇ ਕਿ ਉਹ ਡਿਜ਼ੀਟਲ ਐਪਸ ਦੇ ਨਾਲ ਆਪਣਾ ਸਮਾਨ ਵੇਚਣ ਅੱਜ ਕੱਲ੍ਹ ਦੇ ਇਸ ਟੈਕਨੋਲਜੀ ਦੇ ਯੁੱਗ ਦੇ ਵਿੱਚ ਲੋਕ ਸਾਰੀ ਸ਼ੋਪਿੰਗ ਆਪਣਾ ਸਾਰਾ ਸਮਾਨ ਔਨਲਾਈਨ ਖਰੀਦਣਾ ਪਸੰਦ ਕਰਦੇ ਹਨ ਅਤੇ ਇਹ ਡਿਜ਼ੀਟਲ ਐਪਸ ਨੇ ਭਾਰਤ ਵਿੱਚ ਵਪਾਰ ਨੂੰ ਇਸ ਕਦਰ ਤੱਕ ਬਦਲ ਦਿੱਤਾ ਗਿਆ ਹੈ ਕਿ ਇਸ ਦਾ ਬਹੁਤ ਹੀ ਜ਼ਿਆਦਾ ਖਤਰਨਾਕ ਪ੍ਰਭਾਵ ਵਪਾਰੀਆਂ ਅਤੇ ਖ ਸਮਾਨ ਖਰੀਦਣ ਵਾਲਿਆਂ 'ਤੇ ਬਣਿਆ ਹੈ ਕਿਉਂਕਿ ਜ਼ਿਆਦਾਤਰ ਲੋਕ ਔਨਲਾਈਨ ਸਮਾਨ ਖਰੀਦਣਾ ਪਸੰਦ ਕਰਦੇ ਹਨ ਅਤੇ ਉਹ ਦੁਕਾਨਾਂ 'ਤੇ ਜਾਣਾ ਨਹੀਂ ਪਸੰਦ ਕਰਦੇ ਜਿਸ ਕਾਰਨ ਉਹਨਾਂ ਨੂੰ ਕਈ ਵਾਰ ਗਲਤ ਵਸਤੂ ਵੀ ਮਿਲ ਜਾਂਦੀ ਹੈ ਅਤੇ ਫਿਰ ਨਾ ਉਸ ਨੂੰ ਉਹ ਵਾਪਸ ਕਰ ਪਾਉਂਦੇ ਹਨ ਅਤੇ ਉਹਨਾਂ ਨੂੰ ਸਹੀ ਵਸਤੂ ਨਹੀਂ ਮਿਲਦੀ ਜਿਸ ਕਾਰਨ ਇਸ ਵਿੱਚ ਛੋਟੇ ਵਪਾਰੀ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਗ੍ਰਾਹਕ ਦਾ ਵੀ ਨੁਕਸਾਨ ਹੁੰਦਾ ਹੈ